ਬਾਈ ਜੀ ਕਿੱਦਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੀ ਅਨੂ ਸ਼ਰਮਾ ਬੋਲ ਰਹੇ ਹੋ ਹਾਂਜੀ ਦੀ ਨਾ ਮੈਂ ਤੁਹਾਡਾ ਨੰਬਰ ਲਿਆ ਸੀ ਆਪਣੀ ਇੱਕ ਫਰੈਂਡ ਤੋਂ ਮੈਂ ਵੀ ਐਕੁਚਲੀ ਨਵਾਂ ਸ਼ਹਿਰ ਤੋਂ ਹੀ ਰਹਿੰਦੀ ਹਾਂ ਅਤੇ ਮੈਂ ਤੁਹਾਡੇ ਕੋਲ ਇਨਫੋਰਮੇਸ਼ਨ ਲੈਣੀ ਸੀ ਇੱਥੇ ਦੇ ਸਕੂਲਸ ਬਾਰੇ ਕਿ ਮੈਂ ਆਪਣੇ ਬੱਚਿਆਂ ਨੂੰ ਪੜ੍ਹਨ ਸਕੂਲ ਵਿੱਚ ਸਟਾਰਟਿੰਗ ਏ ਜਿਹੇ ਕਰਨੀ ਆ ਉਹਦੀ ਅਤੇ ਹਾਂਜੀ ਪ੍ਰੀ ਨਰਸਰੀ ਵਗੈਰਾ ਤਾਂ ਉਹਦੀ ਹੋ ਗਈ ਆ ਅਤੇ ਹੁਣ ਜਿਹੜੀ ਉਹਦੀ ਬੇਸ ਮਤਲਬ ਕਿ ਸਟਾਰਟਿੰਗ ਤੋਂ ਉਹਨੂੰ ਸਕੂਲ ਲਾਉਣਾ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਨਵਾਂ ਸ਼ਹਿਰ ਏਰੀਆ 'ਚ ਜਿਹੜੇ ਬੈਸਟ ਸਕੂਲ ਕਿਹੜੇ ਕਿਹੜੇ ਆ ਜਿੱਥੇ ਮਤਲਬ ਕਿ ਅਦਰ ਐਕਟੀਵਿਟੀਜ਼ ਵੀ ਕਰਾਈਆਂ ਜਾਣ ਸਟੱਡੀ ਦੇ ਨਾਲ ਨਾਲ ਰਿਲੇਟਿਡ ਮੈਮ ਮੈਂ ਤਾਂ ਸੀ ਬੀ ਐੱਸ ਈ ਨੂੰ ਪ੍ਰੈਫਰ ਕਰਾਂਗੀ ਠੀਕ ਹੈ ਠੀਕ ਹੈ ਮੈਮ ਥੈਂਕ ਯੂ ਸੋ ਮੱਚ ਬਸ ਮੈਮ ਇੱਦਾਂ ਹੈ ਕਿ ਉੱਥੇ ਸਕੂਲ ਵਾਲੇ ਬਸ ਫੈਸਿਲਿਟੀ ਤਾਂ ਮਿਲ ਰਹੀ ਹੈ ਨਾ ਸਕੂਲ ਦੀ ਓਕੇ ਓਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੁਸੀਂ ਇੰਨੀ ਇਨ ਅ ਇਨਫੋਰਮੇਸ਼ਨ ਦਿੱਤੀ ਓਕੇ ਥੈਂਕ ਯੂ ਸੋ ਮੱਚ